ਮੇਰਾ ਨਾਮ ਰਾਕੇਸ਼ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਇਸ ਸਬੰਧ ਵਿੱਚ ਕਾਲ ਕੀਤੀ ਸੀ ਕਿ ਮੈਨੂੰ ਮੇਰੀ ਸਹੇਲੀ ਕੋਲੋਂ ਪਤਾ ਲੱਗਿਆ ਸੀ ਕਿ ਸਾਡੇ ਇੱਥੇ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਿਆ ਹੈ ਅਤੇ ਉਸਨੇ ਮੈਨੂੰ ਤੁਹਾਡੇ ਰੈਸਟੋਰੈਂਟ ਬਾਰੇ ਜਾਣਕਾਰੀ ਦਿੱਤੀ ਇੱਥੇ ਬਹੁਤ ਵਧੀਆ ਖਾਣ ਵਾਸਤੇ ਚੀਜ਼ਾਂ ਮਿਲਦੀਆਂ ਹਨ ਉਸਨੇ ਮੈਨੂੰ ਇਹ ਗੱਲ ਵੀ ਦੱਸੀ ਕਿ ਇਹ ਰੈਸਟੋਰੈਂਟ ਆਨਲਾਈਨ ਡਿਲੀਵਰੀ ਵੀ ਕਰ ਦਿੰਦਾ ਹੈ ਜੋ ਅਸੀਂ ਘਰ ਬੈਠ ਕੇ ਹੀ ਬੁੱਕ ਕਰਵਾ ਸਕਦੇ ਹਾਂ ਅਤੇ ਕੁਝ ਘੰਟਿਆਂ ਪਹਿਲਾਂ ਮੈਂ ਤੁਹਾਡੇ ਰੈਸਟੋਰੈਂਟ ਵਾਲੀ ਐਪ 'ਚ ਖਾਣ ਵਾਸਤੇ ਕੁਝ ਆਈਟਮਾਂ ਵੇਖ ਰਹੀ ਸੀ ਜਿਸ ਵਿੱਚ ਮੈਂ ਅਤੇ ਕੁਝ ਆਇਟਮਾਂ ਦਾ ਚੁਣਾਵ ਕੀਤਾ ਹੈ ਜਿਹਨਾਂ ਦਾ ਨਾਮ ਸੀ ਦੋ ਪਲੇਟ ਸਮੋਸੇ ਚਾਰ ਆਈਸਕ੍ਰੀਮ ਦੇ ਕੱਪ ਦੋ ਫੈਂਟਾਂ ਦੀ ਬੋਤਲਾਂ ਤਿੰਨ ਲਿਮਕਾ ਦੀ ਬੋਤਲਾਂ ਅਤੇ ਦੋ ਕੌਕ ਦੀਆਂ ਬੋਤਲਾਂ ਅਤੇ ਇਸ ਦੇ ਨਾਲ ਮੈਂ ਆਰਡਰ ਦਿੰਦੇ ਸਮੇਂ ਗਲਤੀ ਨਾਲ ਕੁਝ ਹੋਰ ਆਈਟਮਾਂ ਦਾ ਵੀ ਚੁਣਾਵ ਕਰ ਰਿਹਾ ਸੀ ਜਿਹਨਾਂ ਦਾ ਨਾਂ ਹੈ ਇੱਕ ਆਲੂ ਦਾ ਪਰਾਂਠਾ ਇੱਕ ਡੋਸਾ ਅਤੇ ਇਡਲੀ ਸਾਂਬਰ ਇਹ ਤਿੰਨ ਚਾਰ ਆਇਟਮਾਂ ਹਨ ਜਿਹਨਾਂ ਦਾ ਚੁਣਾਵ ਮੇਰੇ ਕੋਲੋਂ ਗਲਤੀ ਨਾਲ ਹੋ ਗਿਆ ਹੈ ਮੈਂ ਤੁਹਾਨੂੰ ਇਸ ਸੰਬੰਧ ਵਿੱਚ ਹੀ ਕਾਲ ਕੀਤੀ ਹੈ ਕਿ ਕਿਰਪਾ ਕਰਕੇ ਮੇਰੀਆਂ ਆਈਟਮਾਂ ਦੀ ਸੂਚੀ ਵਿੱਚੋਂ ਇਸ ਨੂੰ ਹਟਾ ਦਿੱਤਾ ਜਾਵੇ ਬਾਕੀ ਦੀਆਂ ਆਈਟਮਾਂ ਮੇਰੇ ਐਡਰੈਸ 'ਤੇ ਜਲਦੀ ਤੋਂ ਜਲਦੀ ਡਿਲਿਵਰੀ ਕਰ ਦਿੱਤੀਆਂ ਜਾਣ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਮੈਂ ਸਾਰੀਆਂ ਆਈਟਮਾਂ ਦਾ ਭੁਗਤਾਨ ਆਨਲਾਈਨ ਪਹਿਲਾਂ ਹੀ ਕਰ ਦਿੱਤਾ ਸੀ ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਵਿੱਚੋਂ ਤਿੰਨ ਚਾਰ ਆਈਟਮਾਂ ਮੈਂ ਗਲਤੀ ਨਾਲ ਆਰਡਰ ਕਰ ਦਿੱਤੀਆਂ ਹਨ ਇਹਨਾਂ ਨੂੰ ਮੇਰੀ ਸੂਚੀ ਦੇ ਵਿੱਚੋਂ ਹਟਾ ਦਿੱਤਾ ਜਾਵੇ ਅਤੇ ਕਿਰਪਾ ਕਰਕੇ ਬਣਦੇ ਹੋਏ ਪੈਸੇ ਮੈਨੂੰ ਮੇਰੇ ਅਕਾਊਂਟ ਦੇ ਵਿੱਚ ਵਾਪਸ ਜੋੜ ਦਿੱਤੇ ਜਾਣ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ